ਸਤਿ ਸ਼੍ਰੀ ਅਕਾਲ ਵੀਰੇ ਕੈਬ ਬੁੱਕ ਤੋਂ ਬੋਲ ਰਹੇ ਹੋ ਮੈਂ ਦੋ ਘੰਟੇ ਪਹਿਲਾਂ ਹੀ ਕੈਬ ਬੁੱਕ ਔਡਰ ਕੀਤੀ ਸੀ ਅਤੇ ਮੈਨੂੰ ਡਰਾਈਵਰ ਨੇ ਕਿਹਾ ਸੀ ਮੈਂ ਅੱਧੇ ਘੰਟੇ ਤੱਕ ਪਹੁੰਚ ਜਾਊਂਗਾ ਅਤੇ ਤੁਸੀਂ ਮ ਮੈਨੂੰ ਘੰਟਾ ਹੋ ਗਿਆ ਖੜ੍ਹੀ ਨੂੰ ਇੰਨੀ ਜ਼ਿਆਦਾ ਗਰਮੀ ਆ ਅਤੇ ਧੁੱਪ ਬਹੁਤ ਜ਼ਿਆਦਾ ਅਤੇ ਡਰਾਈਵਰ ਹਾਲੇ ਤੱਕ ਆਇਆ ਨਹੀਂ ਅਤੇ ਮੈਂ ਉਸਨੇ ਮੈਨੂੰ ਕਿਹਾ ਸੀ ਕਿ ਮੈਂ ਅੱਧੇ ਘੰਟੇ ਨੂੰ ਆਜੂੰਗਾ ਉਹ ਹਾਲੇ ਤੱਕ ਆਇਆ ਨਹੀਂ ਗਰਮੀ ਬਹੁਤ ਜ਼ਿਆਦਾ ਅਤੇ ਮੈਂ ਕੈਬ ਬੁੱਕ ਔਡਰ ਕੀਤੀ ਸੀ ਉਹ ਹਾਲੇ ਤੱਕ ਆਇਆ ਨਹੀਂ ਅਤੇ ਪਲੀਜ਼ ਜਲਦੀ ਤੋਂ ਜਲਦੀ ਕੈਬ ਬੁੱਕ ਪਹੁੰਚਾ ਦਿਓ ਕਿਉਂਕਿ ਮੇਰਾ ਅੱਜ ਪੇਪਰ ਹੈ ਦੋ ਘੰਟੇ ਘੰਟੇ ਨੂੰ ਮੇਰਾ ਪੇਪਰ ਸਟਾਰਟ ਆ ਅਤੇ ਜੇ ਮੈਂ ਪੇਪਰ ਨਾ ਦਿੱਤਾ ਤਾਂ ਮੈਂ ਫੇਲ ਹੋਜੂੰਗੀ ਪਲੀਜ਼ ਇਸ ਕਰਕੇ ਜਲਦੀ ਤੋਂ ਜਲਦੀ ਕੈਬ ਬੁੱਕ ਭੇਜ ਭੇਜ ਦਿਓ ਅਤੇ ਇਹ ਮਤਲਬ ਮੈਂ ਪੇਪਰ ਦੇ ਸਕਾਂ ਅਤੇ ਮੈਂ ਵਧੀਆ ਨੰਬਰ ਲੈ ਕੇ ਪਾਸ ਹੋ ਸਕਾਂ ਅਤੇ ਪਲੀਜ਼ ਤੁਸੀਂ ਜਲਦੀ ਤੋਂ ਜਲਦੀ ਕੈਬ ਬੁੱਕ ਭੇਜ ਦਿਓ ਮੈਂ ਅੱਗੇ ਤੋਂ ਵੀ ਤੁਹਾਡੀ ਕੈਬ ਬੁੱਕ ਔਡਰ ਕਰਾਂਗੀ ਅਤੇ ਜੇ ਤੁਸੀਂ ਹੁਣ ਮੈਨੂੰ ਜਲਦੀ ਤੋਂ ਜਲਦੀ ਮੇਰੇ ਸਕੂਲ ਤੱਕ ਪਹੁੰਚਾ ਦਿੱਤਾ ਅਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੀ ਅਤੇ ਪਲੀਜ਼ ਡਰੈਵਰ ਨੂੰ ਕਹਿ ਦਿਓ ਕਿ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਕੈਬ ਬੁੱਕ ਹੋਏ ਮੈਂ ਪੂਰੀ ਤੇ ਪੂਰੀ ਮਨੀ ਦਊਂਗੀ ਜੇ ਉਹ ਟਾਈਮ ਹੋਰ ਲਾਊਗਾ ਤਾਂ ਮੈਂ ਮਨੀ ਘੱਟ ਦਊਂਗੀ